ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਨਾ ਇਹਦੇ 'ਚ ਗੀਤਾਂ ਦੀਆਂ ਗਲਤੀਆਂ ਹਥਿਆਰਾਂ ਨੂੰ ਪ੍ਰਮੋਟ ਕਰਨਾ ਅਤੇ ਜ਼ਿਆਦਾਤਰ ਲੱਚਰਵਾਰਤਾ ਫੈਲਾਉਣੀ ਅਤੇ ਗਲਤ ਕਰਨੀ ਨਸ਼ੇ ਕਰਨੇ ਨਸ਼ੇ ਕਰਕੇ ਗਾਇਕੀ ਦੇ ਵਿੱਚ ਆਉਣਾ ਇਹ ਸਭ ਤੋਂ ਵੱਡੀਆਂ ਗਲਤੀਆਂ ਨੇ ਜੇਕਰ ਗਾਇਕ ਪੁਰਾਣੇ ਵਿਰਸੇ ਨੂੰ ਜਾਂ ਪੁਰਾਣੇ ਇਤਿਹਾਸ ਨੂੰ ਪੜ੍ਹ ਕੇ ਗਾਉਣ ਪੜ੍ਹ ਕੇ ਸੁਣਾਉਣ ਅਤੇ ਉਹਨਾਂ ਤੋਂ ਜਿਹੜੇ ਆਉਣ ਵਾਲੇ ਨਵੀਂ ਪੀੜ੍ਹੀ ਹੈ ਉਹ ਜਾਗਰੂਕ ਹੋ ਸਕਦੀ ਹੈ ਉਹਨੂੰ ਵੇਖ ਕੇ ਇਤਿਹਾਸ ਸੁਣਾਉਣ ਕਿ ਸਾਡਾ ਪਿਛੋਕੜ ਇਤਿਹਾਸ ਕੀ ਹੈ ਅਤੇ ਸਾਡੇ ਪੁਰਾਣਾ ਵਿਰਸਾ ਕੀ ਹੈ ਹੁਣ ਦੀ ਗਾਇਕੀ ਹੈ ਜਿਹੜੀ ਨੌਜਵਾਨਾਂ ਨੂੰ ਜਿਹੜੀ ਹੁਣ ਦੀ ਗਾਇਕੀ ਹੈ ਨੌਜਵਾਨਾਂ ਨੂੰ ਭੜਕਾਉਂਦੀ ਹੈ ਨਸ਼ਿਆਂ ਵੱਲ ਲੈ ਕੇ ਜਾਂਦੀ ਹੈ ਹਥਿਆਰਾਂ ਅਤੇ ਚੁੱਕਣ ਦਾ ਫਾਇਦਾ ਉਠਾਉਂਦੇ ਨੇ ਉਹਨਾਂ ਨੂੰ ਗਲਤ ਪਾਸੇ ਤੋਰਦੀ ਹੈ ਜਿਹੜੀ ਹੁਣ ਦੀ ਨਵੀਂ ਗਾਇਕੀ ਹੈ ਧੰਨਵਾਦ